ਮੇਰਾ ਛੋਟੇ ਹੁੰਦੇ ਤੋਂ ਹੀ ਸੁਪਨਾ ਸੀ ਕਿ ਮੈਂ ਅਫ਼ਰੀਕਾ ਦੀ ਇੱਕ ਕੰਟਰੀ ਜਿਹਦਾ ਨਾਮ ਇਜ਼ਿਪਟ ਹੈ ਉੱਥੇ ਜਾਵਾਂ ਕਿਉਂਕਿ ਇਜ਼ਿਪਟ ਦੁਨੀਆ ਦੀ ਸਭ ਤੋਂ ਪੁਰਾਣੀ ਕੰਟਰੀ ਹੈ ਜਿੱਥੇ ਦੁਨੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਜਿਹਨੂੰ ਅਸੀਂ ਇਜਿਪਸ਼ਨ ਸਿਵਲਾਈਜੇਸ਼ਨ ਪਾਈ ਜਾਂਦੀ ਹੈ ਸੋ ਉੱਥੇ ਕੀ ਆ ਪਿਰਾਮਿਡਸ ਪਾਏ ਜਾਂਦੇ ਹੈ ਜਿਹਦੇ ਵਿੱਚ ਕੀ ਆ ਉਸ ਸਿਵਲਾਈਜੇਸ਼ਨ ਬਾਰੇ ਕਾਫ਼ੀ ਜ਼ਿਆਦਾ ਨੌਲੇਜ ਸਾਨੂੰ ਮਿਲਦੀ ਹੈ ਸੋ ਮੈਂ ਉਹਨਾਂ ਪਿਰਾਮਿਡਸ ਨੂੰ ਦੇਖਣਾ ਚਾਹਵਾਂਗੀ ਔਰ ਉੱਥੇ ਜਾ ਕੇ ਉਹਨਾਂ ਪਿਰਾਮਿਡ ਦੇ ਵਿੱਚ ਜਿਹੜੀ ਇਜਿਪਸ਼ਨ ਲੈਂਗੁਏਜ ਲਿਖੀ ਹੋਈ ਆ ਉਹਨੂੰ ਡੀਕੋਡ ਕਰਨਾ ਚਾਹਵਾਂਗੀ ਅਤੇ ਉਸ ਤੋਂ ਬਾਅਦ ਉਹਨੂੰ ਡੀਕੋਡ ਕਰਨ ਤੋਂ ਬਾਅਦ ਜੋ ਉਹਨਾਂ ਦੇ ਰਹਿਣ ਸਹਿਣ ਦਾ ਢੰਗ ਸੀਗਾ ਤਰੀਕਾ ਸੀਗਾ ਉਹ ਕਿਵੇਂ ਰਹਿੰਦੇ ਸੀ ਕੀ ਖਾਂਦੇ ਸੀ ਕੀ ਪੀਂਦੇ ਸੀ ਅਤੇ ਉਹ ਸਿਵਲਾਈਜੇਸ਼ਨ ਕਿਵੇਂ ਖ਼ਤਮ ਹੋ ਗਈ ਉਹ ਲੋਕ ਕਿੱਥੇ ਚਲੇ ਗਏ ਉਹਨਾਂ ਦੇ ਅਗਰ ਹੁਣ ਕੋਈ ਪਿੱਛੇ ਪੂਰਵਜ ਜਾਂ ਉਹਨਾਂ ਦੀ ਕੋਈ ਜਨਰੇਸ਼ਨ ਮਿਲਦੀ ਹੈ ਤਾਂ ਉਹ ਕਿੱਥੇ ਮਿਲਦੀ ਹੈ ਕਿਵੇਂ ਉਹ ਲੋਕ ਰਹਿੰਦੇ ਨੇ ਸੋ ਸਾਰੀਆਂ ਚੀਜ਼ਾਂ ਬਾਰੇ ਮੈਂ ਪਤਾ ਕਰਨਾ ਚਾਹਵਾਂਗੀ ਸੋ ਮੇਰਾ ਸ਼ੁਰੂ ਤੋਂ ਹੀ ਇਹ ਡ੍ਰੀਮ ਰਿਹਾ ਹੈ ਕਿ ਮੈਂ ਹਮੇਸ਼ਾ ਇਜ਼ਿਪਟ ਕੰਟਰੀ ਨੂੰ ਦੇਖਣ ਜਾਵਾਂ ਸੋ ਬੇਸਿਕਲੀ ਇਜ਼ਿਪਟ ਅਫ਼ਰੀਕਾ ਮਹਾਂਦੀਪ ਦੀ ਇੱਕ ਕੰਟਰੀ ਹੈ ਸੋ ਜਿੱਥੇ ਦਾ ਕਿ ਜੋ ਕਲਾਈਮੇਟ ਹੈ ਉਹ ਕਾਫ਼ੀ ਜ਼ਿਆਦਾ ਗਰਮ ਹੈ ਕਿਉਂਕਿ ਉਹ ਸਹਾਰਾ ਮਾਰੂਥਲ ਦੇ ਵਿੱਚ ਪਾਈ ਜਾਂਦੀ ਹੈ ਉਹਦੇ ਨਾਲ ਹੀ ਰੈੱਡ ਸੀਅ ਆ ਜਾਂਦਾ ਅਤੇ ਇੱਕ ਬੜੀ ਫੇਮਸ ਕਹਾਵਤ ਵੀ ਹੈ ਕਿ ਇਜ਼ਿਪਟ ਜੋ ਹੈ ਰਿਵਰ ਨਾਈਲ ਦਾ ਗਿਫ਼ਟ ਹੈ ਸੋ ਉੱਥੇ ਥੋੜ੍ਹੀ ਬਹੁਤੀ ਫਰਟਾਇਲ ਲੈਂਡ ਵੀ ਪਾਈ ਜਾਂਦੀ ਹੈ ਸੋ ਮੈਂ ਇਜ਼ਿਪਟ ਕੰਟਰੀ ਘੁੰਮਣ ਜਾਣਾ ਚਾਹਵਾਂਗੀ